ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਛੱਬੀ ਜਨਵਰੀ ਉੱਨੀ ਸੌ ਪੰਜਾਹ ਚਾਰ ਜੁਲਾਈ ਉੱਨੀ ਸੌ ਚੋਹਠ ਚੌਦਾਂ ਫਰਵਰੀ ਉੱਨੀ ਸੌ ਚੁਹੱਤਰ ਦਸ ਅਗਸਤ ਉੱਨੀ ਸੌ ਉਣਹੱਤਰ